ਸੱਭਿਆਚਾਰ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਹੈ ਪੁਰਾਤਨ ਸਮੇਂ ਵਿੱਚ ਗੁਰੂਆਂ ਦੁਆਰਾ ਅਤੇ ਸੂਫ਼ੀ ਸੰਤਾਂ ਦੁਆਰਾ ਸੱਭਿਆਚਾਰ ਦੀ ਪੂਰੀ ਪੈਰਵਾਈ ਕੀਤੀ ਜਾਂਦੀ ਸੀ ਜਿਸ ਨਾਲ ਆਮ ਪਰਿਵਾਰਾਂ ਵਿੱਚ ਵੀ ਇਹ ਸੇਧ ਮਿਲਦੀ ਰਹਿੰਦੀ ਸੀ ਅਤੇ ਉਨ੍ਹਾਂ ਪਰਿਵਾਰਾਂ ਤੋਂ ਅੱਗੇ ਦੂਜੀ ਆਉਣ ਵਾਲੀ ਪੀੜੀ ਵੀ ਸਭ ਕੁਛ ਸਿੱਖਦੀ ਰਹਿੰਦੀ ਸੀ ਪਰ ਅੱਜ ਮੋਬਾਇਲ ਅਤੇ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਸੱਭਿਆਚਾਰਕ ਰੀਤਾਂ ਬਹੁਤ ਤੇਜ਼ੀ ਨਾਲ ਖ਼ਤਮ ਹੁੰਦੀਆਂ ਜਾ ਰਹੀਆਂ ਹਨ ਇਸ ਦੇ ਵਿੱਚ ਨੌਜਵਾਨ ਪੀੜੀ ਲਗਾਤਾਰ ਨਸ਼ਿਆਂ ਦੇ ਵਿੱਚ ਗਲਤਾਨ ਹੁੰਦੀ ਜਾ ਰਹੀ ਹੈ ਅਤੇ ਜਿਸ ਵਿੱਚ ਪੱਛਮ ਦਾ ਪ੍ਰਭਾਵ ਸਾਫ਼ ਵਿਖਾਈ ਦਿੰਦਾ ਹੈ ਹੁਣ ਦੀ ਪੀੜੀ ਆਪਣੇ ਮਾਂ ਪਿਉ ਤੋਂ ਵੀ ਉਹ ਗੱਲਾਂ ਨਹੀਂ ਸਿੱਖ ਪਾਉਂਦੀ ਜੋ ਪੁਰਾਤਨ ਸਮੇਂ ਦੇ ਵਿੱਚ ਗੁਰਬਾਣੀ ਅਤੇ ਗੁਰੂਆਂ ਸੂਫ਼ੀ ਸੰਤਾਂ ਦੁਆਰਾ ਸਿੱਖੀਆਂ ਜਾਂਦੀਆਂ ਸਨ ਇਸ ਲਈ ਇਹ ਸੱਭਿਆਚਾਰਕ ਕਦਰਾਂ ਕੀਮਤਾਂ 'ਤੇ ਪਕੜ ਜੋ ਹੈ ਉਹ ਢਿੱਲੀ ਪੈਂਦੀ ਜਾ ਰਹੀ ਹੈ